ਬਾਈਕਿੰਗ ਦਾ ਸਭ ਤੋਂ ਜ਼ਿਆਦਾ ਖ ਖਤਰਾ ਬਾਈਕ ਤੋਂ ਗਿਰ ਡਿੱਗ ਕੇ ਘੜੀਸਣ ਘੜੀਸਣ ਕਾਰਨ ਸੱਟ ਲੱਗਣ ਦਾ ਹੈ ਅਤੇ ਇਸ ਲਈ ਇਸ ਦੇ ਲਈ ਸਾਡੇ ਕੋਲ ਫਸਟ ਏਡ ਦੇ ਵਿੱਚ ਇੱਕ ਫਸਟ ਏਡ ਓਇੰਟਮੈਂਟ ਅਤੇ ਪੱਟੀ ਦਾ ਸੁਵਿਧਾ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਜਾਂਦੇ ਹੋਏ ਰਾਹ ਵਿੱਚ ਜ਼ਿਆਦਾ ਟਾਈਮ ਟਰੈਵਲ ਕਰਨ ਕਾਰਨ ਕਈ ਵਾਰ ਡਾਇਰੀਆ ਅਤੇ ਅਗ ਹੋਰ ਚੀਜ਼ਾਂ ਕਾਰਨ ਸਾਨੂੰ ਖਤਰਾ ਜਾਂ ਹੋ ਸਕਦਾ ਹੈ ਅਤੇ ਕਈ ਵਾਰ ਜ਼ਿਆਦਾ ਟ੍ਰੈਵਲਿੰਗ ਕਰਨ ਕਾਰਨ ਡੀਹਾਈਡ੍ਰੇਸ਼ਨ ਦੇ ਨਾਲ ਸਾਨੂੰ ਓ ਆਰ ਐੱਸ ਰੋਜ਼ ਪੀਣਾ ਚਾਹੀਦਾ ਹੈ ਰੋਜ਼ ਤਾ ਮਤਲਬ ਜਦੋਂ ਅਸੀਂ ਬਾਈਕ ਚਲਾਉਣੀ ਹੈ ਉਦੋਂ ਸਾਨੂੰ ਓ ਆਰ ਐੱਸ ਦਾ ਵੀ ਓ ਆਰ ਐੱਸ ਵੀ ਪੀਣਾ ਚਾਹੀਦਾ ਹੈ ਤਾਂ ਕਿ ਸਾਡੀ ਬੋਡੀ ਦੇ ਵਿੱਚ ਇਲੈਕਟ੍ਰੋਲਾਇਟਸ ਦੀ ਮਾਤਰਾ ਘਟੇ ਨਾ